ਮੇਰੀ ਮਨਪਸੰਦ ਫਿਲਮ ਜਵਾਨ ਹੈ ਜੋ ਕਿ ਅਜੇ ਥੋੜ੍ਹੇ ਸਮੇਂ ਪਹਿਲਾਂ ਹੀ ਆਈ ਹੈ ਦੋ ਹਜ਼ਾਰ ਤੇਈ ਵਿੱਚ ਸ਼ਾਹਰੁਖ ਖਾਨ ਨੇ ਹੀ ਅਜੇ ਲਾਂਚ ਕੀਤੀ ਆ ਉਸ ਵਿੱਚ ਸ਼ਾਹਰੁਖ ਖਾਨ ਨੇ ਬਹੁਤ ਹੀ ਵਧੀਆ ਫਿਲਮ ਦਾ ਰੋਲ ਦਿਖਾਇਆ ਹੋਇਆ ਹੈ ਕਿਉਂਕਿ ਜੋ ਕਿ ਜਿਸ ਵਿੱਚ ਇੱਕ ਸੀਨ ਹੈ ਜੋ ਕਿ ਇੱਕ ਕਿਸਾਨ ਮਜ਼ਦੂਰ ਕਿਵੇਂ ਇੱਕ ਟਰੈਕਟਰ ਖਰੀਦਦਾ ਹੈ ਅਤੇ ਕਿਵੇਂ ਉਸ ਕੋਲ ਉਹ ਕਰਜ਼ਾ ਵਸੂਲ ਕਰਨ ਲਈ ਆਉਂਦੇ ਹਨ ਜੇਕਰ ਉਹ ਆਪਣਾ ਮੁਨਾਫਾ ਨਹੀਂ ਦੇ ਪਾ ਰਿਹਾ ਅਤੇ ਕਿਸ ਤਰ੍ਹਾਂ ਉਸ ਦੀ ਸਾਰੇ ਭਰੇ ਗਾਂਓ ਵਿੱਚ ਬੇਇੱਜ਼ਤੀ ਕੀਤੀ ਜਾਂਦੀ ਹੈ ਤਾਂ ਕਿ ਜੋ ਕਿ ਉਹ ਇਸ ਕਰਜ਼ੇ ਦੌਰਾਨ ਆਪਣੀ ਮੌਤ ਵੀ ਕਰ ਲੈਂਦਾ ਹੈ ਹੱਤਿਆ ਵੀ ਕਰ ਲੈਂਦਾ ਹੈ ਜਿਸ ਤਰ੍ਹਾਂ ਉਹ ਫਾਂਸੀ ਦਾ ਫੰਦਾ ਆਪਣੇ ਆਪ ਨੂੰ ਲਗਾ ਲੈਂਦਾ ਹੈ ਕਿਉਂਕਿ ਅੱਜ ਕੱਲ੍ਹ ਕਿਸਾਨ ਬਹੁਤ ਹੀ ਬੇਰੁਜ਼ਗਾਰ ਸਨ ਜਿ ਅਤੇ ਇਹ ਪਾਰਟੀ ਕਮੇਟੀਆਂ ਜੋ ਕਿ ਕਿਸਾਨਾਂ ਨੂੰ ਆਪਣੇ ਝੰਜਟਾਂ ਵਿੱਚ ਬੈਂਕ ਦੇ ਲੋਨ ਦੇ ਵਿੱਚ ਫਸਾ ਦਿੰਦੀਆਂ ਸਨ ਅਤੇ ਉਹ ਆਪਣਾ ਕਰਜ਼ਾ ਨਹੀਂ ਦੇ ਪਾ ਰਹੇ ਹੁੰਦੇ ਜਿਸ ਤਰ੍ਹਾਂ ਵੀ ਉਹ ਆਪਣਾ ਕਰਜ਼ਾ ਦਿੰਦੇ ਹਨ ਲੇਕਿਨ ਉਹਨਾਂ ਨੂੰ ਇਸ ਤਰ੍ਹਾਂ ਉਹਨਾਂ ਦੇ ਨਾਲ ਬੁਰਾ ਵਿਵਹਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਕਿਸਾਨ ਦੀ ਇਹ ਟਰੈਕਟਰ 'ਤੇ ਬਹੁਤ ਹੀ ਜ਼ਿਆਦਾ ਪਰਸੈਂਟ ਰੇਟ 'ਤੇ ਵਿਆਜ ਲਗਾਇਆ ਜਾਂਦਾ ਹੈ ਤਾਂ ਕਿ ਜਿਸ ਤਰ੍ਹਾਂ ਉਹ ਇਸ ਕਰਜ਼ੇ ਵਿੱਚ ਫਸ ਜਾਂਦੇ ਹਨ ਅਤੇ ਤਾਂ ਕਿ ਜੋ ਕਿ ਉਹਨਾਂ ਨੂੰ ਇਹ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਕਰਕੇ ਉਹ ਆਪਣੇ ਆਪ ਨੂੰ ਫਾਂਸੀ ਲਗਾ ਕੇ ਆਤਮ ਹੱਤਿਆ ਵੀ ਕਰ ਲੈਂਦੇ ਹਨ ਇਸ ਤਰ੍ਹਾਂ ਉਸ ਫਿਲਮ ਵਿੱਚ ਇਹ ਵੀ ਸੀਨ ਦਿਖਾਇਆ ਗਿਆ ਹੈ ਕਿ ਕਿਵੇਂ ਇੱਕ ਡੋਕਟਰ ਡੋਕਟਰ ਕੋਲ ਬੱਚੇ ਆਉਂਦੇ ਸਨ ਕਿ ਉਹ ਬੱਚੇ ਕਿੰਨੀ ਤਕਲੀਫ ਵਿੱਚ ਹੁੰਦੇ ਸਨ ਇਸ ਕਰਕੇ ਉਹਨਾਂ ਨੂੰ ਆਕਸੀਜਨ ਦੀ ਘਾਟ ਵੀ ਉਹ ਪੂਰੀ ਨਹੀਂ ਕਰ ਪਾਏ ਕਿਉਂਕਿ ਇਹ ਉੱਪਰਲੇ ਪੋਲੀਟੀਸ਼ਨ ਦਾ ਹੱਥ ਹੁੰਦਾ ਹੈ ਕਿਉਂਕਿ ਹਰ ਚੀਜ਼ ਉਸ ਵਿੱਚ ਇਹ ਵਿਖਾਈ ਗਈ ਹੈ ਕਿ ਕਿਵੇਂ ਕਿਵੇਂ ਇੱਕ ਇੱਕ ਚੀਜ਼ ਕਿਸ ਤਰ੍ਹਾਂ ਉੱਪਰੋਂ ਫੰਡਸ ਦੇ ਨਾਲ ਆਉਂਦੇ ਹਨ ਇੱਕ ਇੱਕ ਬੰਦੇ ਦੀ ਕਮਿਸ਼ਨ ਐਡ ਕੀਤੀ ਹੁੰਦੀ ਹੈ ਕਿਸੇ ਤਰ੍ਹਾਂ ਉਹ ਡਾਕਟਰ ਨੇ ਜਾ ਕੇ ਕਿਸੇ ਦੇ ਹੱਥ ਪੱਲੇ ਜੋੜ ਕੇ ਉਹ ਔਕਸੀਜਨ ਪਾਈਪ ਲਿਆਂਦੀ ਲੇਕਿਨ ਫਿਰ ਵੀ ਉਹ ਬੱਚੇ ਨਾ ਬਚ ਸਕਣ ਅਤੇ ਫਿਰ ਵੀ ਉਸ